ਪੰਜਾਬ ਦਾ ਸੱਭਿਆਚਾਰ ਬਹੁਤ ਵਧੀਆ ਸੱਭਿਆਚਾਰ ਹੈ ਜਿਸ ਵਿੱਚ ਪੰਜਾਬੀ ਭੰਗੜਾ ਗਿੱਧਾ ਬਹੁਤ ਮਸ਼ਹੂਰ ਹੈ ਪੰਜਾਬ ਵਿੱਚ ਬਹੁਤ ਹੀ ਵਧੀਆ ਜਰਨੈਲ ਹੋਏ ਹਨ ਜੋ ਜਿਹਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਜਿਹਨਾਂ ਨੇ ਪੰਜਾਬ ਨੂੰ ਲੁੱਟਣ ਤੋਂ ਬਚਾਇਆ ਜਦੋਂ ਵੀ ਹਿੰਦੁਸਤਾਨ ਗੁਲਾਮ ਹੁੰਦਾ ਸੀ ਤਾਂ ਮੁਗਲ ਹਿੰਦੁਸਤਾਨ ਦਾ ਲੁੱਟਿਆ ਹੋਇਆ ਮਾਲ ਪੰਜਾਬ ਦੇ ਰਸਤੇ ਹੀ ਬਾਹਰ ਨੂੰ ਲੈ ਕੇ ਜਾਂਦੇ ਸੀ ਅਤੇ ਪੰਜਾਬ ਦੇ ਰਸਤੇ ਹੀ ਆਉਂਦੇ ਸੀ ਜਿਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਨੇ ਮੁਗਲਾਂ ਨੂੰ ਰੋਕਿਆ ਅਤੇ ਹਿੰਦੁਸਤਾਨ ਨੂੰ ਬਚਾਇਆ ਪੰਜਾਬ ਦਾ ਭਾਰਤ ਦੀ ਸ਼ੀ ਭਾਰਤ ਦੀ ਅਜਾਦੀ ਵਿੱਚ ਵੀ ਬਹੁਤ ਵੱਡਾ ਹਿੱਸਾ ਹੈ ਜਿਸ ਵਿੱਚ ਸ਼ਹੀਦ ਭਗਤ ਸਿੰਘ ਸ਼ਹੀਦ ਊਧਮ ਸਿੰਘ ਨੇ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਨੂੰ ਅਜ਼ਾਦ ਕਰਵਾਇਆ ਅਤੇ ਅਸੀਂ ਅੱਜ ਅਜ਼ਾਦ ਬੈਠੇ ਹਾਂ ਅਜ਼ਾਦ